ਮੈਂ ਇੱਕ ਕਿਸਾਨ ਹਾਂ ਜੋ ਕਿ ਖੇਤੀ ਨਾਲ ਜੁੜਿਆ ਹ ਜੁੜਿਆ ਹੋਇਆ ਹਾਂ ਮੈਂ ਅੱਜ ਵੀ ਆਪਣੇ ਖੇਤਾਂ ਵਿੱਚ ਫਸਲਾਂ ਉਗਾਉਂਦਾ ਹਾਂ